ਸਤਿ ਸ਼੍ਰੀ ਅਕਾਲ ਜੀ ਤੁਸੀਂ ਓਲਾ ਤੋਂ ਬੋਲ ਰਹੇ ਹੋ ਮੈਂ ਇੱਕ ਆਟੋ ਬੁੱਕ ਕਰਨਾ ਸੀਗਾ ਮੈਂ ਫਤਿਹਗੜ੍ਹ ਸਾਹਿਬ ਤੋਂ ਬੋਲ ਰਹੀ ਹਾਂ ਬੱਸ ਸਟੈਂਡ ਮੈਂ ਇੱਥੇ ਬੱਸ ਸਟੈਂਡ 'ਤੇ ਖੜ੍ਹੀ ਹਾਂ ਅਤੇ ਮੈਂ ਚੰਡੀਗੜ੍ਹ ਜਾਣਾ ਸੀਗਾ ਮੇਰਾ ਅੱਜ ਪੇਪਰ ਹੈ ਗੌਰਮੈਂਟ ਇਗਜ਼ਾਮ ਅਤੇ ਮੈਂ ਉਹ ਦੇਣ ਵਾਸਤੇ ਜਾਣਾ ਸੀਗਾ ਅਤੇ ਮੈਂ ਇੱਕ ਘੰਟਾ ਪਹਿਲਾਂ ਉੱਥੇ ਪਹੁੰਚਣਾ ਚਾਹੁੰਦੀ ਹਾਂ ਕੀ ਤੁਸੀਂ ਹੁਣ ਆ ਸਕਦੇ ਹੋ ਤਾਂ ਜੋ ਆਪਾਂ ਪਹਿਲਾਂ ਪਹੁੰਚ ਸਕੀਏ